ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਘਰ ਦੇ ਕੰਮ ਕਰਦੇ ਸਮੇਂ ਬਹੁਤ ਗੀਤ ਸੁਣਦੀ ਹਾਂ ਮੇਰੇ ਪੰਜਾਬੀ ਸਿੰਗਰ ਸੁਰਿੰਦਰ ਕੌਰ ਬੀਬਾ ਜੀ ਮੇਰੇ ਫੇਵਰਟ ਨੇ ਅਤੇ ਮੇਰੇ ਸਪੋਟੀਫਾਈ 'ਤੇ ਉਹਨਾਂ ਦੀ ਲਿਸਟ ਬਣੀ ਹੋਈ ਹੈ ਇਹਨਾਂ ਦੀ ਗੀਤਾਂ ਦੀ ਜੋ ਮੈਂ ਟਰੈਵਲਿੰਗ ਕਰਦੇ ਹੋਏ ਵੀ ਸੁਣਦੀ ਹਾਂ ਅਤੇ ਘਰ ਦੇ ਕੰਮ ਕਰਦੇ ਹੋਏ ਵੀ ਸੁਣਦੀ ਹਾਂ ਅਤੇ ਮੇਰੇ ਕੰਨਾਂ 'ਚ ਹੁੰਦੇ ਆ ਅਤੇ ਮੇਰਾ ਮੰਨਣਾ ਜਿਹੜੀ ਮਿਊਜ਼ਿਕ ਹੈ ਨਾ ਬੰਦੇ ਦੀ ਵੀ ਇੱਕ ਇਹੋ ਜਿਹਾ ਮੈਡੀਡੇਸ਼ਨ ਹੈ ਇਹੋ ਜਿਹੀ ਮੈਡੀਸ਼ੇਸ਼ਨ ਹੈ ਜਿਹਨਾਂ ਨੂੰ ਉਹਨਾਂ ਦੇ ਦਿਮਾਗ ਵਿੱਚ ਕੋਈ ਵੀ ਟੈਨਸ਼ਨ ਹੋਵੇ ਕੋਈ ਵੀ ਉਹਨਾਂ ਨੂੰ ਮਨੋਵਿਗਿਆਨ ਜਿਹੜਾ ਮਨ ਦਾ ਆਪਦਾ ਕੋਈ ਵੀ ਸਟਰੈਸ ਹੁੰਦਾ ਉਹ ਉਤਰ ਜਾਂਦਾ ਅਤੇ ਮੈਂ ਕਹਿੰਦੀ ਹੁੰਦੀ ਹਾਂ ਵੀ ਸਾਰਿਆਂ ਨੂੰ ਹੀ ਮਿਊਜਿਕ ਸੁਣਨਾ ਚਾਹੀਦਾ ਪਾਠ ਸੁਣ ਲਓ ਹੈ ਨਾ ਪਾਠ ਵੀ ਵਧੀਆ ਲੱਗਦਾ ਇੱਕ ਸਾਊਂਡ 'ਚ ਆਪਾਂ ਕੀਰਤਨ ਸੁਣਦੇ ਹਾਂ ਜਿਹੜਾ ਉਹ ਵੀ ਬਹੁਤ ਵਧੀਆ ਲੱਗਦਾ ਅਤੇ ਮੈਂ ਔਲਮੋਸਟ ਜਦੋਂ ਘਰ ਦਾ ਕੰਮ ਕਰਦੀ ਹਾਂ ਅਤੇ ਮੇਰੇ ਕੰਨਾਂ 'ਚ ਹੈਡਫੋਨ ਹੁੰਦੇ ਅਤੇ ਮੈਂ ਬਹੁਤ ਪਿਆਰ ਨਾਲ ਅਤੇ ਬਹੁਤ ਆਰਾਮ ਨਾਲ ਆਪਣਾ ਘਰ ਦਾ ਕੰਮ ਕਰਦੀ ਰਹਿੰਦੀ ਹਾਂ ਜਿਸ ਵਿੱਚ ਮੈਂ ਮੈਨੂੰ ਬਹੁਤ ਸਕੂਨ ਮਿਲਦਾ ਅਤੇ ਮੇਰਾ ਕੰਮ ਵੀ ਬਹੁਤ ਸੋਹਣਾ ਹੁੰਦਾ ਅਤੇ ਨਾਲੇ ਮੈਨੂੰ ਇੱਦਾਂ ਲੱਗਦਾ ਵੀ ਮੇਰਾ ਕੰਮ ਵੀ ਜਿਹੜਾ ਬਹੁਤ ਜਲਦੀ ਖਤਮ ਹੋ ਗਿਆ ਅਤੇ ਮੈਂ ਕਿਤੇ ਵੀ ਬਾਹਰ ਜਾਣਾ ਹੁੰਦਾ ਤਾਂ ਮੈਂ ਆਪਣੇ ਹੈਡਫੋਨ ਤਾਂ ਜ਼ਰੂਰ ਆਪਣੇ ਪਰਸ 'ਚ ਰੱਖਦੀ ਕਿਉਂਕਿ ਮੈਂ ਬਹੁਤ ਸਾਰਾ ਮਿਊਜ਼ਿਕ ਜਿਹੜਾ ਸੁਣਨ 'ਚ ਬਹੁਤ ਇੰਟਰਸਟਿਡ ਰਹਿੰਦੀ ਅਤੇ ਮੈਨੂੰ ਬਹੁਤ ਸ਼ੌਕ ਵੀ ਹੈ ਮਿਊਜ਼ਿਕ ਸੁਣਨ ਦਾ ਅਤੇ ਮੈਂ ਹਰੇਕ ਨੂੰ ਹੀ ਕਹਿੰਦੀ ਹੁੰਦੀ ਕਿ ਵੀ ਯਾਰ ਲਾਈਫ 'ਚ ਨਾ ਦਸ ਪੰਦਰਾ ਮਿੰਟ ਜ਼ਰੂਰ ਇੱਕ ਦਿਨ 'ਚ ਮਿਊਜਿਕ ਹੈ ਜਿਹੜਾ ਸੁਣਿਆ ਕਰੋ ਕਿਉਂਕਿ ਉਹਦੇ ਨਾਲ ਤੁਹਾਡੇ ਮਾਇੰਡ 'ਚ ਜਿੰਨਾ ਵੀ ਸਟਰੈਸ ਹੁੰਦਾ ਉਹ ਖਤਮ ਹੁੰਦਾ ਥੈਂਕ ਯੂ